ਹੈਲੋ ਕੇਸਰ ਢਾਬਾ ਹਾਂਜੀ ਭਾਅ ਜੀ ਤੁਹਾਨੂੰ ਸਵੇਰੇ ਦੁਪਹਿਰ ਦੇ ਖਾਣੇ ਦਾ ਔਡਰ ਕੀਤਾ ਹੋਇਆ ਅਜੇ ਤੱਕ ਖਾਣਾ ਨਹੀਂ ਪਹੁੰਚਿਆ ਦੋ ਵੱਜ ਗਏ ਨੇ ਲਿਖੋ ਫਿਰ ਹੁਣ ਦੁਬਾਰਾ ਔਡਰ ਲਿਖੋ ਵੀਹ ਪਰੌਂਠੇ ਦੋ ਪਲੇਟਾਂ ਦਾਲ ਦੋ ਪਲੇਟਾਂ ਰਾਇਤਾ ਇੱਕ ਪਲੇਟ ਪਾਲਕ ਪਨੀਰ ਇੱਕ ਮਿਕਸ ਸਬਜ਼ੀ ਦੋ ਪਲੇਟਾਂ ਛੋਲੇ ਹਾਂਜੀ ਹੁਣ ਅੱਧੇ ਘੰਟੇ ਤੱਕ ਪਹੁੰਚਾ ਦੇਣਾ ਦੁਬਾਰਾ ਮੈਨੂੰ ਫ਼ੋਨ ਨਾ ਕਰਨਾ ਪਵੇ ਹਾਂਜੀ ਲਿਖੋ ਐਡਰੈੱਸ ਲਿਖੋ ਉਨਾਹਠ ਈਸਟਮੋਨ ਨਗਰ